ਹਾਂਜੀ ਨਮਸਕਾਰ ਜੀ ਹਾਂਜੀ ਬੋਲਦੇ ਜੀ ਹਾਂ ਹਾਂ ਜੀ ਅਸੀਂ ਅਸੀਂ ਮਾਨਸਾ ਸ਼ਹਿਰ 'ਚ ਹੁਣ ਨਵੇਂ ਨਵੇਂ ਆਏ ਹਾਂ ਜੀ ਆਪਣੇ ਮਾਨਸਾ ਸ਼ਹਿਰ ਬਾਰੇ ਕੁਛ ਜਾਣਕਾਰੀ ਲੈਣੀ ਸੀ ਤੁਹਾਤੋਂ ਹਾਂਜੀ ਹਾਂ ਪਹਿਲੇ ਤਾਂ ਜੀ ਆਪਣਾ ਮੇਨ ਤਾਂ ਸੈਕਟਰ ਆਪਣੇ ਹੈਗੇ ਨੇ ਕਿਹੜੇ ਕਿਹੜੇ ਰੋਡ 'ਤੇ ਨੇ ਜੀ ਕਿਹੋ ਜਿਹੇ ਹੈਗੇ ਨੇ ਜੀ ਜੀ ਜੀ ਜੀ ਜੀ ਜੀ ਜੀ ਜੀ ਹਾਂਜੀ

ਜੀ ਜੀ ਜੀ ਓਕੇ ਜੀ ਦੂਸਰਾ ਆਪਣੀਆਂ ਜਿਸ ਤਰ੍ਹਾਂ ਕਿ ਆਪਣੇ ਰੋਡ ਜੀ ਦੂਸਰਾ ਹਾਂਜੀ ਦੂਸਰਾ ਸੈਕਟਰ ਜੇ ਖੋਖਰ ਰੋਡ 'ਤੇ ਖੋਖਰ ਰੋਡ 'ਤੇ ਜੀ ਜੀ ਜੀ ਜੀ ਅਤੇ ਠੀਕ ਹੈ ਜੀ ਠੀਕ ਹੈ

ਜੀ ਜੀ ਜੀ ਇਸ ਤੋਂ ਇਸ ਤੋਂ ਇਲਾਵਾ ਹੋਰ ਕੋਈ ਹੋਰ ਕੋਈ ਘੁੰਮਣ ਵਾਲੀ ਜਗ੍ਹਾ ਜੀ ਦੇਖਣ ਵਾਲੀ ਦੇਖਣਯੋਗ ਮਾਨਸਾ ਸ਼ਹਿਰ ਜੀ ਜੀ ਜੀ ਜੀ ਜੀ

ਠੀਕ ਠੀਕ ਹੈ ਜੀ ਠੀਕ ਹੈ ਜੀ ਜਾਣਕਾਰੀ ਦੇਣ ਲਈ ਆਪਦਾ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਸੰਪਰਕ ਕਰਦੇ ਰਹਾਂਗੇ ਜੀ ਹਾਂਜੀ